ਕਬੱਡੀ ਖੇਡ ਸਾਡੇ ਪੰਜਾਬ ਦੀ ਬਹੁਤ ਪੁਰਾਣੀ ਖੇਡ ਹੈ ਪਹਿਲਾਂ ਦੇ ਲੋਕ ਇਸ ਨੂੰ ਖੇਡਦੇ ਸਨ ਤਾਂ ਸਿਹਤਮੰਦ ਵੀ ਰਹਿੰਦੇ ਸੀ ਹੁਣ ਦੇ ਲੋਕ ਸਿਰਫ ਫੋਨ ਹੀ ਦੇਖਦੇ ਹਨ ਕੋਈ ਗੇਮ ਨਹੀਂ ਖੇਡਦੇ ਕਬੱਡੀ ਦੇ ਨਿਯਮ ਹੈਗੇ ਆ ਖੇਡ ਦੋ ਟੀਮਾਂ ਵਿਚਕਾਰ ਹੁੰਦੀ ਹੈ ਹਰੇਕ ਟੀਮ ਵਿੱਚ ਚੌਦ੍ਹਾਂ ਚੌਦ੍ਹਾਂ ਖਿਡਾਰੀ ਹੁੰਦੇ ਹਨ ਛੇ ਖਿਡਾਰੀ ਬਦਲਵੇਂ ਹੁੰਦੇ ਹਨ ਖਿਡਾਰੀ ਦੇ ਕੋਈ ਕੜਾ ਮੁੰਦਰੀ ਆਦਿ ਨਹੀਂ ਪਾਇਆ ਹੁੰਦਾ ਕੋਈ ਵੀ ਖਿਡਾਰੀ ਲਗਾਤਾਰ ਦੋ ਵਾਰੀ ਹਮਲਾ ਨਹੀਂ ਕਰ ਸਕਦਾ ਜੇਕਰ ਕੋਈ ਖਿਡਾਰੀ ਦਾਅ ਪਾਉਣ ਸਮੇਂ ਸਾਹ ਰਾਹ ਵਿੱਚ ਤੋੜ ਦਵੇ ਤਾਂ ਰੈਫਰੀ ਦੁਬਾਰਾ ਦਮ ਪਾਉਣ ਲਈ ਕਹਿੰਦਾ ਹੈ ਮੈਦਾਨ ਤੋਂ ਬਾਹਰ ਖਿਡਾਰੀਆਂ ਨੂੰ ਕੋਚਿੰਗ ਦੇਣਾ ਵੀ ਮਨ੍ਹਾਂ ਹੁੰਦੀ ਹੈ ਖਿਡਾਰੀ ਕੇਵਲ ਨੰਗੇ ਪੈਰੀ ਹੀ ਖੇਡ ਸਕਦਾ ਹੁੰਦਾ ਹੈ